ਮੇਰੇ ਵੱਲੋਂ ਆਖਰੀ ਕਿਤਾਬ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਸਾਖੀ 'ਤੇ ਪੜ੍ਹੀ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੱਸੇ ਗਏ ਇਹ ਜੀਵਨ ਯਾਤਰਾ ਬਾਰੇ ਸੁਣ ਕੇ ਪੜ੍ਹ ਕੇ ਬਹੁਤ ਮਾਂ ਬਹੁਤ ਹੀ ਮੈਨੂੰ ਪ੍ਰਭਾਵਿਤ ਕੀਤਾ ਇਸਦਾ ਕਾਰਨ ਇਹ ਸੀ ਕਿ ਉਹਨਾਂ ਨੇ ਆਪਣਾ ਪੂਰਾ ਸਰਬੰਸ ਦੇਸ਼ ਕੌਮ ਲਈ ਵਾਰਿਆ ਸੀ ਉਹਨਾਂ ਨੇ ਊਚ ਨੀਚ ਜੂ ਛੂਤ ਛਾਤ ਦੇ ਸਭ ਭੇਦਭਾਵ ਖ਼ਤਮ ਕੀਤੇ ਸੀ ਖਾਲਸਾ ਰਾਜ ਦੀ ਸਿਰਜਣਾ ਕੀਤੀ ਸੀ ਖਾਲਸਾ ਲੋਕਾਂ ਨੂੰ ਇਹ ਦੱਸਿਆ ਸੀ ਕਿ ਊਚ ਨੀਚ ਭੇਦਭਾਵ ਦੇ ਜਾਤੀ ਧਰਮਵਾਦ 'ਚੋਂ ਬਾਹਰ ਨਿਕਲੋ ਅਤੇ ਆਪਣੀ ਇੱਕ ਅਖੰਡ ਦੇਸ਼ ਦੀ ਸਥਾਪਨਾ ਕਰੋ ਨਹੀਂ ਤਾਂ ਹਮੇਸ਼ਾ ਹੀ ਬਾਹਰੋਂ ਬਾਹਰੀ ਸ਼ਕਤੀਆਂ ਤੁਹਾਡੇ ਦੇਸ਼ ਉੱਤੇ ਹਮਲਾ ਕਰਨਗੀਆਂ ਅਤੇ ਉਹਨਾਂ ਨੇ ਇਹ ਹਿੰਦੂ ਧਰਮ ਦੀ ਰਕਸ਼ਾ ਵਾਸਤੇ ਵੀ ਜੋ ਆਪਣਾ ਸਰਬੰਸ ਵਾਰਿਆ ਆਪਣੇ ਚਾਰ ਪੁੱਤਰ ਵਾਰੇ ਆਪਣੇ ਪਿਤਾ ਜੀ ਦਾ ਸੀਸ ਕੁਰਬਾਨ ਕੀਤਾ ਪਰ ਮੈਂ ਸਾਰੀ ਪੁਸਤਕ ਪੜ੍ਹ ਕੇ ਬਹੁਤ ਹੀ ਮਨ ਨੂੰ ਪ੍ਰਭਾਵਿਤ ਹੋਇਆ ਕਿ ਅਸੀਂ ਜਿਸ ਚੀਜ਼ਾਂ ਤੋਂ ਨਿਕਲੇ ਸੀ ਅੱਜ ਫਿਰ ਉਹੀ ਜੁਗ 'ਤੇ ਦੁਬਾਰਾ ਉਹੀ ਚੱਲ ਰਿਹਾ ਫਿਰ ਤੋਂ ਹਿੰਦੂ ਸਿੱਖ ਮੁਸਲਮਾਨ ਇਹੋ ਚੀਜ਼ਾਂ ਚੱਲ ਰਹੀਆਂ ਨੇ ਇਹਦਾ ਸਿੱਟਾ ਕੀ ਨਿਕਲੇਗਾ ਆਖਿਰਕਾਰ ਵਿੱਚ ਵਿਦੇਸ਼ੀ ਤਾਕਤਾਂ ਸਾਡੇ ਉੱਤੇ ਹਮਲਾ ਕਰਨਗੀਆਂ ਫਿਰ ਗੁਲਾਮੀ ਦੇ ਰਾਹ 'ਤੇ ਅਸੀਂ ਖੁਦ ਤੁਰ ਰਹੇ ਹਾਂ ਸਾਨੂੰ ਜਦ ਕਿ ਇਹਨਾਂ ਚੀਜ਼ਾਂ ਤੋਂ ਪਰੇ ਰਹਿਣਾ ਚਾਹੀਦਾ ਅਤੇ ਸਾਨੂੰ ਆਪਣੀ ਜੀਵਨਸ਼ੈਲੀ ਨੂੰ ਉੱਚਾ ਬਣਾਉਣਾ ਚਾਹੀਦਾ ਹੈ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਸਾਖੀ ਤੋਂ ਇਹੀ ਸਿੱਖਿਆ ਪ੍ਰਾਪਤ ਕੀਤੀ ਹੈ ਕਿ ਆਪਣੇ ਕਿਰਦਾਰ ਨੂੰ ਉੱਚਾ ਰੱਖੋ ਆਪਣੇ ਜੀਵਨ ਸ਼ੈਲੀ ਨੂੰ ਇਹੋ ਜਿਹਾ ਬਣਾਓ ਕਿ ਲੋਕ ਤੁਹਾਨੂੰ ਸਲਾਮਾਂ ਕਰਨ ਉਹਨਾਂ ਦੀ ਸਿੱਖਿਆ ਉਹਨਾਂ ਦੀ ਇਹ ਆਪਣੇ ਆਪ ਨੂੰ ਦ੍ਰਿੜ ਇਰਾਦੇ ਵਾਲਾ ਬਣਾਓ ਸਭ ਹੀ ਮਾਨਵ ਨੂੰ ਇੱਕ ਪਹਿਚਾਣੋਂ ਸ਼ੁਕ